ਹੈਲੋ ਹਾਂਜੀ ਮੈਮ ਮੈਂ ਮਲਕੀਤ ਕੌਰ ਬੋਲ ਰਹੀ ਹਾਂ ਹਾਂਜੀ ਮੈਮ ਅਸੀਂ ਫਰੀਦਕੋਟ ਤੋਂ ਆਏ ਹਾਂ ਤੁਹਾਡਾ ਨੰਬਰ ਦਿੱਤਾ ਸੀ ਉੱਥੋਂ ਤੁਹਾਡੇ ਜਾਣ ਪਛਾਣ ਵਾਲਿਆਂ ਨੇ ਕਿਸੇ ਨੇ ਅਤੇ ਹਾਂਜੀ ਅਸੀਂ ਪਟਿਆਲੇ ਰਹਿਣ ਆਏ ਹਾਂ ਤੁਹਾਡਾ ਨਾਮ ਅਮਨਦੀਪ ਕੌਰ ਹੈ ਜੀ ਹਾਂਜੀ ਸਾਨੂੰ ਨਾ ਇੱਥੇ ਨਵੇਂ ਆਏ ਹੋਣ ਕਰਕੇ ਇਹ ਨਹੀਂ ਪਤਾ ਹੈਗਾ ਵੀ ਇੱਥੋਂ ਤਾਜ਼ੀਆਂ ਸਬਜ਼ੀਆਂ ਕਿੱਥੋਂ ਮਿਲਦੀਆਂ ਨੇ ਕੀ ਤੁਸੀਂ ਸਾਨੂੰ ਦੱਸ ਸਕਦੇ ਹੋ ਹਾਂਜੀ ਅੱਛਾ ਜੀ

ਅੱਛਾ ਜੀ ਹਾਂਜੀ ਮੈਮ ਹਾਂਜੀ ਮੈਮ ਅਸੀਂ ਹਾਂਜੀ ਮੈਮ ਅਸੀਂ ਸ਼ਨੀਵਾਰ ਜਿਹੜੀ ਸਬਜ਼ੀ ਲੈਣ ਜਾਣਾ ਐਂ ਅਤੇ ਤੁਹਾਨੂੰ ਸ਼ੁੱਕਰਵਾਰ ਫੋਨ ਕਰ ਲਵਾਂਗੇ ਫਿਰ ਤੁਹਾਡੇ ਨਾਲ ਹੀ ਚਲੇ ਜਾਵਾਂਗੇ ਅਸੀਂ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ

ਠੀਕ ਹੈ ਠੀਕ ਐੈ ਜੀ ਠੀਕ ਹੈ ਜੀ ਥੈਂਕ ਯੂ ਮੈਮ ਹਾਂਜੀ ਹਾਂਜੀ ਹਾਂਜੀ ਇੱਕ ਦਿਨ ਪਹਿਲਾਂ ਦੱਸ ਦੇਵਾਂਗੇ ਹਾਂਜੀ ਓ ਓਕੇ ਜੀ ਥੈਂਕ ਯੂ